ਸਕੂਲ ਤੋਂ ਬਾਅਦ ਸ਼ਾਮ ਦੀ ਟਿਊਸ਼ਨ ਸਾਡੇ ਲਈ ਇੱਕ ਇੱਕ ਵੱਖਰਾ ਟਾਈਮ ਹੁੰਦਾ ਆ ਜਿਹਦੇ ਵਿੱਚ ਕਈ ਵਾਰ ਇੱਦਾਂ ਹੁੰਦਾ ਆ ਕਿ ਬੱਚੇ ਨੂੰ ਜੇ ਕੁਛ ਸਮਝ ਨਹੀਂ ਆਉਂਦਾ ਸਕੂਲ ਟਾਈਮ ਦੇ ਵਿੱਚ ਕਿਉਂਕਿ ਸਕੂਲ ਦੇ ਵਿੱਚ ਸਕੂਲ ਦਾ ਟੀਚਰ ਇੱਕ ਹੁੰਦਾ ਹੈ ਔਰ ਬੱਚੇ ਬਹੁਤ ਜ਼ਿਆਦਾ ਹੁੰਦੇ ਹਨ ਔਰ ਕੁਛ ਚੀਜ਼ਾਂ ਉਹ ਬੱਚੇ ਨੂੰ ਸਾਰਿਆਂ ਦੇ ਵਿੱਚ ਪੁੱਛਣ ਨੂੰ ਟੀਚਰ ਨੂੰ ਪੁੱਛਣ ਲਈ ਵੀ ਵਿੱਚ ਹਿਚਕਚਾਹਟ ਮਹਿਸੂਸ ਹੁੰਦੀ ਆ ਉਹ ਪੇ ਮਾਂ ਬਾਪ ਜੇਕਰ ਮਾਂ ਬਾਪ ਪੜ੍ਹੇ ਲਿਖੇ ਹਨ ਤਾਂ ਉਹ ਘਰ ਪੜ੍ਹਾ ਦਿੰਦੇ ਹਨ ਜੇਕਰ ਉਹ ਕੰਮ ਕਾਜ ਕਰਦੇ ਆ ਜਾਂ ਉਹਨਾਂ ਕੋਲ ਸਮਾਂ ਨਹੀਂ ਹੈ ਤਾਂ ਉਹ ਟੀਸ਼ਨਸ ਵਗੈਰਾ ਜਾਂ ਪ੍ਰਾਈਵੇਟ ਕਲਾਸਿਸ ਲਗਾ ਦਿੰਦੇ ਹਨ ਉਹਦੇ ਵਿੱਚ ਬੱਚੇ ਦੀ ਇਨ ਫਿਊਚਰ ਲਈ ਪ੍ਰੋਬਲਮ ਜੋ ਉਹਨਾਂ ਨੂੰ ਜੋ ਕੁਐਰੀ ਹੁੰਦੀ ਆ ਜਾਂ ਉਹਨਾਂ ਨੂੰ ਕੋਈ ਪਰੇਸ਼ਾਨੀ ਹੁੰਦੀ ਆ ਉਹ ਐਕਸਟਰਾ ਟਿਊਸ਼ਨ ਕਲਾਸਿਸ ਲਗਾ ਕੇ ਉਹ ਆਪਣੀਆਂ ਸਲਿਊਸ਼ਨ ਲੈ ਲੈਂਦੇ ਹਨ ਔਰ ਜਿਹਦੇ ਨਾਲ ਉਹਨਾਂ ਦਾ ਟਾਈਮ ਵੀ ਬਚਦਾ ਹੈ ਔਰ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਬਟ ਇਹ ਉਹਨਾਂ ਵਾਸਤੇ ਹੀ ਹੈ ਜਿਹਨਾਂ ਨੂੰ ਮਤਲਬ ਕਿ ਜਿਹਨਾਂ ਵਾਸਤੇ ਟਾਈਮ ਨਾ ਹੋਵੇ ਜਾਂ ਜਿਹਨਾਂ ਕੋਲ ਟਾਈਮ ਦੀ ਬਹੁਤ ਕੰਮ ਹੋਵੇ ਕਿਉਂਕਿ ਅੱਜ ਕੱਲ੍ਹ ਹਰ ਇੱਕ ਮਾਂ ਬਾਪ ਕੰਮ ਕਾਰ ਦੇ ਵਿੱਚ ਬਿਜੀ ਹੁੰਦਾ ਏ ਔਰ ਬੱਚਿਆਂ ਨੂੰ ਪੜ੍ਹਾਉਣ ਲਈ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਇਸੇ ਲਈ ਇਹ ਟਿਊਸ਼ਨਸ ਅਤੇ ਪ੍ਰਾਈਵੇਟ ਕਲਾਸਾਂ ਬਣਾਈ ਹੁੰਦੀਆਂ ਹਨ